ਹੈਲੋ ਸਤਿ ਸ਼੍ਰੀ ਅਕਾਲ ਜੀ ਕਿਹੜੀ ਗੱਡੀ ਚਾਹੀਦੀ ਹੈ ਜੀ ਆਪਣੇ ਆਪਣੇ ਪਾ ਪੰਜ ਚਾਰ ਗੱਡੀਆਂ ਹੈ ਜੀ ਕਿਹੜੀ ਗੱਡੀ ਚਾਹੀਦੀ ਤੁਹਾਨੂੰ ਸਕੋਰਪੀਓ ਦਾ ਜੇ ਲੌਕਲ ਜਾਉਗੇ ਤਾਂ ਜੀ ਫਿਰ ਤਾਂ ਲੈਂਦੇ ਦੋ ਹਜ਼ਾਰ ਜੇ ਬਾਹਰ ਜਾਉਗੇ ਬਾਹਰ ਦਾ ਰੈਂਟ ਚਲਾਈ ਦੇ ਹਿਸਾਬ ਨਾਲ ਹੈ ਉਥੇ ਦਾ ਚਾਰ ਵੀ ਬਣ ਸਕਦਾ ਪੰਜ ਵੀ ਬਣ ਸਕਦਾ ਹੂੰ ਆਲਟੋ ਦਾ ਵੀ ਰੇਟ ਉ ਉਹਦੇ ਨਾਲੋ ਥੋੜ੍ਹਾਂ ਜਿਹਾ ਘੱਟ ਹੈ ਜੀ ਉਹਦਾ ਪੰਦਰਾਂ ਸੌ ਰੁਪਇਆ ਲੈ ਲੈਂਦੇਂ ਦੋ ਹਾਂ ਥੋੜ੍ਹਾ ਬਹੁਤਾ ਲੈਸ ਉਹ ਗੱਡੀ ਦੇ ਹਿਸਾਬ ਨਾਲ ਏ ਬਾਕੀ ਤਾਂ ਰੇਟ ਹੋਰ ਘੱਟ ਜੂਗਾ ਦੇਖਲੋ ਹਾਂਜੀ ਹਾਂਜੀ ਉਹਦਾ ਖਰਚਾ ਉਹਦਾ ਖਰਚਾ ਜੇ ਤੁਸੀਂ ਸਾਨੂੂੰ ਵਿੱਚ ਸਾਡੇ ਕਨੀ ਪਾਉਣਾ ਤਾਂ ਉਹਦਾ ਵਿੱਚੇ ਲਾਦੂਗੇ ਜੇ ਤੁਸੀਂ ਆਪਣੇ ਕਨੀ ਕਰਨਾ ਉਹ ਵੀ ਅਸੀਂ ਤੁਹਾਨੂੰ ਲੈੱਸ ਕਰਦੂਗੇ ਹੈਂ ਜੀ ਹਾਂ ਹਾਂ ਹਾਂ ਘਰ ਤੋਂ ਘਰ ਤੋਂ ਤੁਹਾਨੂੰ ਹਾਂ ਘਰ ਤੋਂ ਤੁਹਾਨੂੰ ਪਿੱਕ ਕਰਕੇ ਲੈ ਕੇ ਜਾਉਗੀ ਜੀ ਗੱਡੀ ਹਾਂ ਜੀ ਹਾਂ ਜੀ ਹਾਂ ਗੱਡੀ ਤਾਂ ਆਪਣੀ ਵੀ ਹੈ ਜੀ ਆਪਣਾ ਚੌਵੀ ਘੰਟੇ ਚੌਵੀ ਘੰਟੋ ਹੈ ਜੀ ਆਪਣਾ ਹੂੰ ਹਾਂਜੀ ਹੁੰ ਹਾਂਜੀ ਹਾਂਜੀ ਓਹਵੀ ਉਹ ਵੀ ਹੋਜੂਗਾ ਹਿੱਲਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਨੀ ਕਰਨੇ ਨੀ ਉਹ ਤਾਂ ਡਿਸਟਰਵ ਕਰੂ ਕੱਲ੍ਹਾ ਡਰਾਈਵਰ ਏ ਹੋਊਗਾ ਹਾਂ ਬਾਕੀ ਖਾਣੇ ਪੀਣੇ ਦਾ ਖਰਚਾ ਥੋਡਾ ਉਹਨਾਂ ਦਾ ਆਪ ਓਕੇ ਜੀ ਓਕੇ ਜੀ